ਸਤਿ ਸ਼੍ਰੀ ਅਕਾਲ ਜੀ ਤੁਸੀਂ ਬਿੱਲੂ ਢਾਬੇ ਤੋਂ ਬੋਲਦੇ ਹੋ ਹਾਂਜੀ ਮੈਂ ਨਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਘੰਟਾ ਕੁ ਪਹਿਲਾਂ ਨਾ ਮੈਂ ਤੁਹਾਡਾ ਢਾਬੇ ਤੋਂ ਖਾਣਾ ਔਡਰ ਕੀਤਾ ਸੀ ਸਾਡੇ ਘਰ ਰਿਸ਼ਤੇਦਾਰ ਆਏ ਸੀ ਅਤੇ ਮੈਥੋਂ ਚਲੋ ਅਚਾਨਕ ਖਾਣਾ ਤਿਆਰ ਨਹੀਂ ਹੋਇਆ ਅਤੇ ਮੈਂ ਔਡਰ ਕੀਤਾ ਤੁਹਾਡਾ ਖਾਣਾ ਪਹਿਲੀ ਗੱਲ ਤਾਂ ਮੇਰੇ ਕੋਲੇ ਪੰਦਰ੍ਹਾਂ ਵੀਹ ਮਿੰਟ ਲੇਟ ਪਹੁੰਚਿਆ ਉਸ ਤੋਂ ਬਾਅਦ ਜਦੋਂ ਮੈਂ ਖਾਣਾ ਲਿਆ ਉਹਨਾਂ ਤੋਂ ਅਤੇ ਜਦੋਂ ਮੈਂ ਖਾਣਾ ਖੋਲ੍ਹ ਕੇ ਵੇਖਿਆ ਪਹਿਲੀ ਗੱਲ ਤਾਂ ਤੁਹਾਡੇ ਖਾਣੇ ਦੀ ਪੈਕਿੰਗ ਹੀ ਬਿਲਕੁਲ ਵਧੀਆ ਨਹੀਂ ਸੀਗੀ ਇੰਨੀ ਜ਼ਿਆਦਾ ਖਰਾਬ ਪੈਕਿੰਗ ਸੀ ਕਿ ਸਾਰਾ ਕੁਛ ਨਾ ਉਹਦੇ ਵਿੱਚ ਇੱਕਦਮ ਨਿਚੋੜਿਆ ਪਿਆ ਸੀ ਫਿੱਸਿਆ ਪਿਆ ਸੀ ਜਦੋਂ ਮੈਂ ਖੋਲ੍ਹ ਕੇ ਵੇਖਿਆ ਅਤੇ ਥੋੜ੍ਹੀ ਸਬਜ਼ੀ ਸੀ ਜਿਹੜੀ ਉਹ ਤਾਂ ਇੰਨੀ ਤੇਲ ਨਾਲ ਭਰੀ ਹੋਈ ਸੀ ਨਾ ਕਿ ਬਹੁਤ ਜ਼ਿਆਦਾ ਉਹ ਤੋਂ ਅਲਕਤ ਆ ਰਹੀ ਸੀ ਉਸ ਤੋਂ ਬਾਅਦ ਜਦੋਂ ਮੈਂ ਪਨੀਰ ਦੀ ਸਬਜ਼ੀ ਦੇਖੀ ਤਾਂ ਉਹ ਇਹ ਤਾਂ ਐਂ ਲੱਗਦਾ ਸੀ ਜਿਵੇਂ ਕਾਫੀ ਸਮਾਂ ਪੁਰਾਣੀ ਬਣੀ ਹੁੰਦੀ ਹੈ ਰੋਟੀਆਂ ਤਾਂ ਇੰਨੀਆਂ ਸਖਤ ਸੀ ਵੀ ਉਹ ਟੁੱਟ ਹੀ ਨਹੀਂ ਰਹੀਆਂ ਸੀ ਲੱਗਦਾ ਹੀ ਨਹੀਂ ਸੀ ਵੀ ਤਾਜ਼ੀਆਂ ਪਕਾਈਆਂ ਹੋਈਆਂ ਮਤਲਬ ਖਾਣਾ ਇੰਨਾਂ ਬੇਕਾਰ ਸੀਗਾ ਕਿ ਮੈਂ ਉਹ ਖਾਣਾ ਨਾ ਰਿਸ਼ਤੇਦਾਰਾਂ ਨੂੰ ਰੱਖ ਹੀ ਨਹੀਂ ਸਕੀ ਮੈਨੂੰ ਇੰਨੀ ਕੁ ਆਵਦੇ ਆਪ 'ਤੇ ਨਮੋਸ਼ੀ ਮਹਿਸੂਸ ਹੋਈ ਅਤੇ ਗੁੱਸਾ ਵੀ ਬਹੁਤ ਆਇਆ ਇੱਕ ਜੀਅ ਤਾਂ ਕਰਦਾ ਸੀ ਕਿ ਮੈਂ ਫੂਡ ਸਪਲਾਈ 'ਚ ਤੁਹਾਡੀ ਸ਼ਿਕਾਇਤ ਕਰਾਂ ਪਰ ਫੇਰ ਮੈਂ ਸੋਚਿਆ ਕਿ ਸ਼ਿਕਾਇਤ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਇਸ ਲਈ ਮੈਂ ਤੁਹਾਨੂੰ ਦੁਬਾਰਾ ਦੱਸਦੀ ਹਾਂ ਕਿ ਤੁਹਾਡੇ ਇੱਕ ਢਾਬੇ ਦਾ ਜਿਹੜਾ ਖਾਣਾ ਸੀ ਉਹ ਬਿਲਕੁਲ ਵੀ ਵਧੀਆ ਨਹੀਂ ਸੀ ਉਹ 'ਚ ਕੋਈ ਮੈਨੂੰ ਕੋਈ ਇਹੋ ਜਿਹੀ ਗੁਣਵਣਤਾ ਨਹੀਂ ਲੱਗੀ ਤੁਹਾਡੇ ਖਾਣੇ ਵਿੱਚ ਤਾਂ ਮੇਰੀ ਤੁਹਾਨੂੰ ਇਹੀ ਸੁਝਾਅ ਏ ਕਿ ਤੁਸੀਂ ਖਾਣੇ 'ਚ ਥੋੜ੍ਹਾ ਜਿਹਾ ਸੁਧਾਰ ਕਰੋ ਤਾਂ ਕਿ ਤੁਹਾਡੀ ਜਿਹੜੀ ਵਿਕਰੀ ਆ ਉਹ ਵੀ ਵੱਧ ਸਕੇ ਅਤੇ ਗਾਹਕ ਵੀ ਤੁਹਾਡੇ ਤੋਂ ਖੁਸ਼ ਹੋ ਸਕਣ ਧੰਨਵਾਦ